ਸਾਡੇ ਪਿੰਡ ਵਿੱਚ ਡਾਂਸ ਬਹੁਤ ਮਹੱਤਵਪੂਰਨ ਹੈ ਇਹੀ ਸਾਂਝੇ ਸਮੇਂ ਅਤੇ ਖੁਸ਼ੀਆਂ ਨੂੰ ਮਨਾਉਣ ਦਾ ਢੰਗ ਹੈ ਮੌਕੇ 'ਤੇ ਲੋਕ ਇਕੱਠੇ ਹੋ ਕੇ ਗੀਤ ਗਾਉਂਦੇ ਹਨ ਅਤੇ ਨੱਚਦੇ ਹਨ ਜੋ ਸੰਸਾਰਿਕ ਪਹਿਰਾਵਾ ਨੂੰ ਜੀਵੰਤ ਰੱਖਦਾ ਹੈ ਇਸ ਨਾਲ ਸਾਥੀਆਂ ਅਤੇ ਭਾਈਚਾਰੇ ਦਾ ਭਾਵ ਬਣਦਾ ਹੈ ਅਤੇ ਦੁੱਖ ਸੁੱਖ ਸਾਂਝਾ ਕਰਨਾ ਆਸਾਨ ਹੁੰਦਾ ਹੈ ਮੈਂ ਵੀ ਇਸ ਵਿੱਚ ਭਾਗ ਲੈ ਕੇ ਅਤੇ ਮੌਜ ਮਾਣਨ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਡਾਂਸ ਸਾਡੇ ਪਿੰਡ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਜੀਵ ਦਾ ਜੀਵਨ ਦਾ ਇੱਕ ਅਟੁੱਟ ਅੰਗ ਹੈ ਇਹ ਵੱਖ ਵੱਖ ਮੌਕਿਆਂ 'ਤੇ ਜਿਵੇਂ ਤਿਉਹਾਰਾਂ ਵਿਆਹ ਅਤੇ ਸਮਾਜਿਕ ਸਮਾਗਮਾਂ ਵਿੱਚ ਕੀਤਾ ਜਾਂਦਾ ਹੈ ਲੋਕ ਡਾਂਸ ਨਾਲ ਆਪਣੇ ਅਵੀਨਵਾਂ ਨੂੰ ਵਿਅਕਤ ਕਰਦੇ ਹਨ ਅਤੇ ਮੌਕੇ ਦੀ ਖੁਸ਼ੀ ਨੂੰ ਸਾਂਝਾ ਕਰਦੇ ਹਨ ਡਾਂਸ ਦੇ ਰੂਪ ਵਿੱਚ ਲੋਕ ਨਾਚ ਭੰਗੜਾ ਗਿੱਧਾ ਅਤੇ ਹੋਰ ਰਵਾਇਤੀ ਨ੍ਰਿਤ ਸ਼ਾਮਿਲ ਹਨ ਜੋ ਹਰ ਪਿੰਡ ਦੇ ਆਪਣੇ ਵਿਸ਼ੇਸ਼ ਰੰਗ ਨੂੰ ਦਿਖਾਉਂਦੇ ਹਨ ਇਸ ਨਾਲ ਸਿੱਖਿਆ ਸੰਸਕ੍ਰਿਤੀ ਅਤੇ ਪੀੜ੍ਹੀਆਂ ਦੇ ਵਿਚਕਾਰ ਸੰਪਰਕ ਬਣਦਾ ਹੈ ਇਸ ਤਰ੍ਹਾਂ ਡਾਂਸ ਸਿਰਫ ਮਨੋਰੰਜਨ ਦਾ ਹੀ ਨਹੀਂ ਸਗੋਂ ਸਾਂਝੇਦਾਰੀ ਅਤੇ ਪਿਆਰ ਦਾ ਇੱਕ ਮਹੱਤਵਪੂਰਨ ਤਰੀਕਾ ਹੈ ਡਾਂਸ ਕਰਨ ਨਾਲ ਪਿੰਡਾਂ ਵਿੱਚ ਲੋਕ ਡਾਂਸ ਜਦੋਂ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਹੈ ਅਤੇ ਇਹ ਇਕੱਠ ਇੱਕ ਦੂਜੇ ਨੂੰ ਦੱਸਦੇ ਹੋਏ ਲੋਕ ਬਹੁਤ ਇੱਕ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਹੈ ਜਿੱਥੇ ਹਰ ਇੱਕ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਆਪਣੋ ਆਪਣੇ ਹਿਸਾਬ ਦੇ ਨਾਲ ਨਾਚ ਕਰਦੇ ਹਨ ਕਿਸੇ ਨੂੰ ਬੋਲੀਆਂ 'ਤੇ ਨੱਚਣਾ ਵਧੀਆ ਲੱਗਦਾ ਹੈ ਭਾਵੇਂ ਬੋਲੀਆਂ ਪਾ ਕੇ ਨੱਚਦੇ ਹਨ